ਮੈਂ ਦੱਸਣਾ ਚਾਹੁੰਦਾ ਹਾਂ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਆਰਥਿਕ ਨੀਤੀਆਂ ਦਾ ਵਿਕਾਸ ਕਈ ਪਹਿਲੂਆਂ 'ਤੇ ਅਧਾਰਿਤ ਸੀ ਸਰਕਾਰ ਨੇ ਖੇਤੀ ਉਦਯੋਗ ਅਤੇ ਵਪਾਰ ਦੇ ਖੇਤਰ ਵਿੱਚ ਵੱਡੇ ਪੱਧਰ ਵਿੱਚ ਨੀਤੀਆਂ ਅਪਣਾਈਆਂ ਖੇਤੀਬਾੜੀ ਦੀਆਂ ਆਰਥਿਕ ਨੀਤੀਆਂ ਜ਼ਮੀਨੀ ਸੰਸ਼ੋਧਨ ਖੇਤੀ ਵਿੱਚ ਜ਼ਮੀਨ ਦੀ ਵੰਡ ਅਤੇ ਨਵੇਂ ਕਿਸਾਨਾਂ ਨੂੰ ਮਦਦ ਕਰਨ ਦੇ ਉਦੇਸ਼ ਨਾਲ ਨੀਤੀਆਂ ਲਾਗੂ ਕੀਤੀਆਂ ਪੰਜਾਬੀਆਂ ਨੂੰ ਉਤਪਾਦਕਤਾ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ ਜਿਵੇਂ ਕਿ ਸਬਜ਼ੀਆਂ ਅਨਾਜ ਫਲਾਂ ਦਾ ਉਤਪਾਦਨ ਵਿੱਚ ਵਾਧਾ ਕਰਨਾ ਪ੍ਰਭਾਵ ਕਿਸਾਨਾਂ ਦੇ ਆਮਦਨ ਵਿੱਚ ਬਹੁਤ ਵਾਧਾ ਹੋਇਆ ਖੇਤੀਬਾੜੀ ਦੇ ਆਧਾਰਿਤ ਸਮਾਜਿਕ ਸੰਰਚਨਾ ਵਿੱਚ ਬਦਲਾਅ ਉਦਯੋਗਿਕ ਵਿਕਾਸ ਹੋਇਆ ਗਣਨਾਵਾਂ ਪਦਾਰਥ ਨਵੇਂ ਉਦਯੋਗਾਂ ਨੂੰ ਪ੍ਰੋਤਸਾਹਨ ਦਿੱਤਾ ਗਿਆ ਜਿਵੇਂ ਕਿ ਖ਼ਾਸ ਕਰਕੇ ਕੱਪੜਾ ਫੂਡ ਪ੍ਰੋਸੈਸਿੰਗ ਸਟੀਲ ਉਦਯੋਗ ਇਸ ਨਾਲ ਹੀ ਫਸਲਾਂ ਦਾ ਜਿਹੜਾ ਰੇਟ ਸੀ ਉਹ ਵੀ ਵਧਾ ਦਿੱਤਾ ਗਿਆ ਜਿਸ ਨਾਲ ਕਿਸਾਨਾਂ ਦੀ ਹਾਲਤ ਕਾਫ਼ੀ ਸੁਧਰ ਗਈ ਅਤੇ ਕਿਸਾਨਾਂ ਦਾ ਜੀਵਨ ਖੁਸ਼ਹਾਲ ਹੋ ਗਿਆ ਧੰਨਵਾਦ